ਮੈਂ ਆਪਣਾ ਕੋਸਮੈਟਿਕਸ ਦਾ ਸਮਾਨ ਜਿਹੜੀ ਦੁਕਾਨ ਤੋਂ ਆਮ ਤੌਰ 'ਤੇ ਖਰੀਦ ਦੀ ਹਾਂ ਮੈਂ ਉਸ ਦੁਕਾਨ 'ਤੇ ਬਾਕੀ ਸਮਾਨ ਜਦੋਂ ਖਰੀਦ ਰਹੀ ਸੀ ਤਾਂ ਮੈਨੂੰ ਦੁਕਾਨਦਾਰ ਨੇ ਇੱਕ ਆਪਣਾ ਇੱਕ ਨਵਾਂ ਪ੍ਰੋਡਕਟ ਦਿਖਾਇਆ ਲਿਪ ਕਰਿਓਨ ਉਹ ਕਹਿਣ ਲੱਗਾ ਕਿ ਆਇਆ ਹੈ ਮਾਰਕੀਟ ਵਿੱਚ ਇਨ ਬੜੀ ਨਵੀਂ ਚੀਜ਼ ਹੈ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ ਬਹੁਤ ਵਧੀਆ ਹੈ ਇਹਦੇ ਬਹੁਤ ਅੱਛੀ ਹੈ ਇਹਦੀ ਫੀਡਬੈਕ ਆ ਰਹੀ ਹੈ ਤਾਂ ਮੈਂ ਉਹਦੇ ਕਹਿਣ 'ਤੇ ਖਰੀਦ ਲਿਆ ਮੈਂ ਕਿਹਾ ਚਲੋ ਨਵੀਂ ਚੀਜ਼ ਹੈ ਮੈਟ ਲਿਪਸਟਿਕ ਟਾਈਪ ਸੀ ਅਤੇ ਇਹ ਚਲੋ ਇਹ ਵਧੀਆ ਮੈਨੂੰ ਦੇਖਣ 'ਚ ਲੱਗੀ ਚੀਜ਼ ਜਦੋਂ ਮੈਂ ਘਰ ਆ ਕੇ ਇਹਨੂੰ ਲਗਾਇਆ ਕੀਤਾ ਮੈਨੂੰ ਬਿਲਕੁਲ ਮਜ਼ਾ ਨਹੀਂ ਆਇਆ ਬਹੁਤ ਜ਼ਿਆਦਾ ਮੈਟ ਸੀ ਬਹੁਤ ਸਖ਼ਤ ਕੋਈ ਗਲੋ ਨਹੀਂ ਆਇਆ ਲਿਪਸ 'ਤੇ ਅਤੇ ਦੋ ਕੁ ਵਾਰੀ ਮੈਂ ਲਗਾਏ ਅਤੇ ਇਹ ਉਸ ਤੋਂ ਬਾਅਦ ਉਹਦੀ ਟਿੱਪ ਟੁੱਟ ਗਈ ਤਾਂ ਮੈਨੂੰ ਬਿਲਕੁਲ ਨਹੀਂ ਚੰਗਾ ਲ ਲੱਗਿਆ ਕਿ ਇੰਨੀ ਮਹਿੰਗੀ ਚੀਜ਼ ਲਈ ਅਤੇ ਉਹ ਤਾਂ ਖ ਖ਼ਤਮ ਵੀ ਹੋ ਗਈ ਉਸ ਤੋਂ ਬਾਅਦ ਕੋਈ ਲਿਪਸੀਟਕ ਅੱਗੋਂ ਹੈ ਹੀ ਨਹੀਂ ਸੀ ਤਾਂ ਫਿਰ ਮੈਂ ਦੁਕਾਨਦਾਰ ਨਾਲ ਦੁਬਾਰਾ ਜਾ ਕੇ ਜਦੋਂ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਕਿ ਤੁਸੀਂ ਇਹਨੂੰ ਸ਼ਾਰਪ ਕਰ ਸਕਦੇ ਹੋ ਇਹ ਨਵੀਂ ਚੀਜ਼ ਹੈ ਨਾ ਇਸ ਕਰਕੇ ਐਸ ਅਸੀਂ ਸ਼ੋਰਪ ਵੀ ਕਰ ਕੇ ਦੇਖਿਆ ਤਾਂ ਉਹ ਕੋਈ ਗੱਲ ਹੀ ਨਹੀਂ ਬਣੀ ਲਗਾ ਕੇ ਕੋਈ ਮਜ਼ਾ ਹੀ ਨਹੀਂ ਆਇਆ ਉਹਨੂੰ ਸ਼ੋਰਪ ਕਰਕੇ ਵੀ ਉਹ ਟਿਪ ਜਿਹੜੀ ਇਹ ਉਹ ਠੀਕ ਤਰੀਕੇ ਬਣਦੀ ਹੀ ਨਹੀਂ ਹੈ ਅਤੇ ਮੈਨੂੰ ਬਿਲਕੁਲ ਮਜ਼ਾ ਨਹੀਂ ਆਇਆ ਮੈਂ ਸੋਚਿਆ ਕਿ ਇਹ ਵਾਲੀ ਜਿਹੜੀ ਹੈ ਨਾ ਇਹ ਕਲਰ ਸਕਰੀਨ ਦੀ ਲਿਪ ਕਰਿਓਨ ਇਹ ਮੈਂ ਅੱਜ ਤੋਂ ਬਾਅਦ ਨਹੀਂ ਖਰੀਦਾ ਖਰੀਦਾਂਗੀ ਮੈਂ ਬਾਕੀ ਜਿਹੜੀਆਂ ਲਿਪਸਟਿਕਸ ਆਮ ਤੌਰ 'ਤੇ ਖਰੀਦ ਦੀ ਹਾਂ ਬ੍ਰਸ਼ ਵਾਲੀਆਂ ਮੈਂ ਅੱਗੇ ਤੋਂ ਉਹ ਹੀ ਖਰੀਦਾਂਗੀ